ਹਾਂ ਮੈਂ ਮਹਿਸੂਸ ਕਰਦਾ ਹਾਂ ਕਿ ਸ਼ਹਿਰ ਦੇ ਅਖ਼ਬਾਰਾਂ ਵਿੱਚ ਪੇਂਡੂ ਖ਼ਬਰਾਂ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਜਾਂਦਾ ਕਿਉਂਕਿ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਸ਼ਹਿਰਾਂ ਨੂੰ ਲੋਕ ਜ਼ਿਆਦਾ ਪੜ੍ਹਨਾ ਅਤੇ ਸੁਣਨਾ ਪਸੰਦ ਕਰਦੇ ਹਾਂ ਕਿਉਂਕਿ ਪਿੰਡ ਥੋੜ੍ਹਾ ਪਿਛੜਾ ਹੋਇਆ ਇਲਾਕਾ ਹੁੰਦਾ ਹੈ ਅਤੇ ਲੋਕ ਇਸ ਚੀਜ਼ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਕਿ ਪਿੰਡ ਦੀਆਂ ਖ਼ਬਰਾਂ ਹੀ ਹੋਣ ਕਿਉਂਕਿ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਸ਼ਹਿਰ ਨੂੰ ਜ਼ਿਆਦਾ ਇਮਪੋਰਟੈਂਸ ਦੇਣੀ ਚਾਹੀਦੀ ਹੈ ਕਿਉਂਕਿ ਸ਼ਹਿਰ ਵਿੱਚ ਹੀ ਸਾਰੀ ਤਰੱਕੀ ਵਾਲੀਆਂ ਗੱਲਾਂ ਹੁੰਦੀਆਂ ਹਨ ਜਿੱਦਾਂ ਕਿ ਕੋਈ ਸਕੂਲ ਵਿੱਚ ਘਟਨਾ ਹੋ ਗਈ ਹੈ ਅਤੇ ਸ਼ਹਿਰ ਵਾਲੀ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ ਜਦੋਂ ਕਿ ਪਿੰਡ ਵਾਲੀਆਂ ਖ਼ਬਰਾਂ ਨੂੰ ਜਾਂ ਤਾਂ ਛੋਟਾ ਜਿਹਾ ਕੋਰਨਰ ਬਣਾ ਕੇ ਲਿਖ ਦਿੱਤਾ ਜਾਂਦਾ ਹੈ ਜਾਂ ਤਾਂ ਫਿਰ ਉਹਨਾਂ ਨੂੰ ਛੱਡ ਹੀ ਦਿੱਤਾ ਜਾਂਦਾ ਹੈ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਸ਼ਹਿਰਾਂ ਵਿੱਚ ਜੇ ਕੋਈ ਆਤਮ ਹੱਤਿਆ ਵੀ ਕਰ ਲੈਂਦਾ ਹੈ ਤਾਂ ਵੀ ਉਹਦੀ ਖ਼ਬਰ ਲਿਖੀ ਜਾਂਦੀ ਹੈ ਪਰ ਅਗਰ ਪਿੰਡ ਵਿੱਚ ਕੋਈ ਬੰਦਾ ਜ਼ਹਿਰ ਖਾ ਕੇ ਮਰ ਜਾਵੇ ਜਾਂ ਫਿਰ ਸ਼ਰਾਬ ਅਤੇ ਨਸ਼ੇ ਨਾਲ ਮਰ ਜਾਵੇ ਤਾਂ ਵੀ ਉਸ ਚੀਜ਼ ਨੂੰ ਨਹੀਂ ਲਿਖਿਆ ਜਾਂਦਾ ਅੱਜ ਕੱਲ੍ਹ ਲੋਕ ਇਹੀ ਚਾਹੁੰਦੇ ਹਨ ਕਿ ਜੋ ਸ਼ਹਿਰ ਜ਼ਿਆਦਾ ਵਿਕਸਿਤ ਹਨ ਉਹਨਾਂ ਦਾ ਹੀ ਜ਼ਿਆਦਾ ਕੁਛ ਲਿਖਿਆ ਜਾਵੇ ਕਿਉਂਕਿ ਮੀਡੀਆ ਵੀ ਉਹੀ ਦਿਖਾਉਣਾ ਚਾਹੁੰਦੀ ਹੈ ਜੋ ਲੋਕ ਦੇਖਣਾ ਚਾਹੁੰਦੇ ਹਨ ਉਹ ਉਹਨਾਂ ਨੂੰ ਵੀ ਆਪਣਾ ਰੁਜ਼ਗਾਰ ਵਧਾਉਣਾ ਹੁੰਦਾ ਹੈ ਮੀਡੀਆ ਨੂੰ ਹਰ ਖ਼ਬਰ ਛਾਪਣੀ ਚਾਹੀਦੀ ਹੈ ਜਿਹਦੇ ਨਾਲ ਕਿ ਹਰ ਦੇਸ਼ ਦੇ ਹਰ ਇੱਕ ਕੋਨੇ ਦਾ ਪਤਾ ਲੱਗੇ ਜਦੋਂ ਕਿ ਮੀਡੀਆ ਵਾਲੇ ਸਿਰਫ਼ ਭੜਕਾਊ ਭਾਸ਼ਣ ਹੀ ਦਿੰਦੇ ਨਜ਼ਰ ਆਉਂਦੇ ਹਨ ਜਿੱਦਾਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਚੈਨਲ ਕਿਸੇ ਬੰਦੇ ਨੇ ਖਰੀਦੇ ਹੁੰਦੇ ਹਨ ਤਾਂ ਉਸ ਬੰਦੇ ਦੀਆਂ ਬੁਰਾਈਆਂ ਨਹੀਂ ਛਾਪੀਆਂ ਜਾਂਦੀਆਂ ਜਾਂ ਦਿਖਾਈਆਂ ਜਾਂਦੀਆਂ ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਰਕਾਰ ਦਾ ਜੇ ਕੋਈ ਚੈਨਲ ਹੈ ਤਾਂ ਸਰਕਾਰ ਸਿਰਫ਼ ਆਪਣੀ ਵਾਹ ਵਾਹ ਹੀ ਕਰਦੀ ਨਜ਼ਰ ਆਏਗੀ ਜਦੋਂ ਕਿ ਬਹੁਤ ਸਾਰੀਆਂ ਕਮੀਆਂ ਹੁੰਦੀਆਂ ਹਨ ਹਰ ਸਰਕਾਰ ਦੇ ਹਰ ਇੱਕ ਬੰਦੇ ਵਿੱਚ ਪਰ ਲੋਕ ਉਹ ਨਹੀਂ ਦੇਖਣਾ ਚਾਹੁੰਦੇ ਕਿਉਂਕਿ ਕਈ ਲੋਕ ਇਹੀ ਸੋਚਦੇ ਹਨ ਕਿ ਉਹਨਾਂ ਦਾ ਲੀਡਰ ਸਭ ਕੁਛ ਸਹੀ ਕਰ ਰਿਹਾ ਹੈ ਅਤੇ ਮੀਡੀਆ ਵਾਲੇ ਵੀ ਉਹੀ ਕੁਛ ਦਿਖਾਉਂਦੇ ਹਨ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਆਉਣ ਵਾਲੀ ਸਰਕਾਰ ਜਾਂ ਮੌਜੂਦਾ ਸਰਕਾਰ ਉਹਨਾਂ ਨਾਲ ਕੁਛ ਕਰ ਨਾ ਦੇਵੇ ਜਾਂ ਉਹਨਾਂ ਦਾ ਚੈਨਲ ਬੰਦ ਨਾ ਕਰ ਦੇਵੇ